ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਮੈਂ ਤਵੇ ਉੱਤੇ ਪਾਪੜ ਤਲ ਰਹੀ ਸੀ ਤਵੇ 'ਤੇ ਤੇਲ ਪਾਇਆ ਪਾਪੜ ਰੱਖ ਦਿੱਤਾ ਪਾਪੜ ਫੁੱਲ ਗਿਆ ਮੈਂ ਉਸਨੂੰ ਥੱਲੇ ਕਰਨ ਲਈ ਕੋਈ ਵੀ ਚਮਚ ਜਾਂ ਚਿਮਟਾ ਨਹੀਂ ਵਰਤਿਆ ਮੈਂ ਹੱਥ ਨਾਲ ਹੀ ਉਸ ਨੂੰ ਥੱਲੇ ਕਰ ਦਿੱਤਾ ਅਤੇ ਇਸ ਤਰ੍ਹਾਂ ਹੋਇਆ ਕਿ ਤੇਲ ਜਿਹੜਾ ਸੀ ਉਹ ਮੇਰੇ ਹੱਥ ਉੱਤੇ ਪੈ ਗਿਆ ਮੇਰਾ ਸੱਜਾ ਹੱਥ ਸੜ ਗਿਆ ਇੰਨੀ ਮੁਸ਼ਕਿਲ ਆਈ ਕਿ ਮੇਰੇ ਹੱਥ ਉੱਤੇ ਛਾਲੇ ਪੈ ਗਏ ਕਾਫ਼ੀ ਦਵਾਈਆਂ ਵੀ ਲਗਾਈਆਂ ਪਰ ਠੀਕ ਹੁੰਦਿਆਂ ਹੁੰਦਿਆਂ ਕਾਫ਼ੀ ਟਾਈਮ ਲੱਗ ਗਿਆ ਮੇਰੇ ਘਰਦਿਆਂ ਦੇ ਉੱਤੇ ਵੀ ਮੇਰੇ ਨਾਲ ਨਾਲ ਮੁਸੀਬਤ ਆਈ ਮ ਸੱਜੇ ਹੱਥ ਨਾਲ ਹੀ ਤਾਂ ਸਾਰਾ ਕੰਮ ਕਰਨਾ ਹੁੰਦਾ ਹੈ ਆਟਾ ਗੁੰਨਣਾ ਰੋਟੀ ਬਣਾਉਣੀ ਸਬਜ਼ੀ ਨੂੰ ਤੜਕਾ ਲਗਾਉਣਾ ਸਬਜ਼ੀਆਂ ਕੱਟਣੀਆਂ ਆਦਿ ਆਦਿ ਇਹ ਸਭ ਕੁਛ ਮੇਰੇ ਹਸਬੈਂਡ ਨੂੰ ਕਰਨਾ ਪਿਆ ਮੈਂ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਕੰਮ ਕਰੋ ਕੋਈ ਵੀ ਮੈਂ ਜਾਂ ਕੋਈ ਹੋਰ ਬੜੇ ਧਿਆਨ ਨਾਲ ਕੰਮ ਕੀਤਾ ਜਾਵੇ ਇੱਕ ਨਿੱਕੀ ਜਿਹੀ ਗਲਤੀ ਨਾਲ ਹੀ ਕਿੰਨਾ ਨੁਕਸਾਨ ਹੋ ਗਿਆ ਕਿੰਨੀ ਪਰੇਸ਼ਾਨੀ ਆਈ ਇਸ ਕਰਕੇ ਸਾਰਿਆਂ ਨੂੰ ਮੈਂ ਇਹ ਹਦਾਇਤ ਕਰਦੀ ਹਾਂ ਜਦੋਂ ਕੋਈ ਕੰਮ ਕਰੋ ਤਾਂ ਠੀਕ ਤਰ੍ਹਾਂ ਕੰਮ ਕਰੋ ਧਿਆਨ ਨਾਲ ਕੰਮ ਕਰੋ